ਗਤਕਾ ਮੁੱਖ ਤੌਰ 'ਤੇ ਮਾਰਸ਼ਲ ਆਰਟ ਹੈ ਅਤੇ ਸਵੈ ਰੱਖਿਆ ਦਾ ਸਾਧਨ ਹੈ ਇਸ ਨੂੰ ਅਸੀਂ ਖੇਡ ਅਤੇ ਸੱਭਿਆਚਾਰਕ ਅਭਿਆਸ ਵੀ ਕਹਿ ਸਕਦੇ ਹਾਂ ਗਤਕਾ ਸਿੱਖ ਧਰਮ ਨਾਲ ਬਹੁਤ ਸੰਬੰਧ ਰੱਖਦਾ ਪੁਰਾਣੇ ਸਮਿਆਂ ਵਿੱਚ ਗਤਕੇ ਨੂੰ ਜੰਗਾਂ ਯੁੱਧਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਵਾਰ ਰੋਕਣ ਵਾਰ ਕਰਨਾ ਗਤਕੇ ਦੇ ਮੁੱਖ ਸਟੈਪ ਹਨ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੇ ਗਤਕੇ ਦੀ ਪ੍ਰੈਕਟਿਸ ਸ਼ੁਰੂ ਕਰਵਾਈ ਸੀ ਅਤੇ ਅੱਜ ਕੱਲ੍ਹ ਇਸ ਨੂੰ ਖੇਡ ਕਹਿ ਦਿੱਤਾ ਜਾਂਦਾ ਸਿੱਖ ਧਰਮ ਨਾਲ ਗਤਕੇ ਦਾ ਖਾਸ ਸੰਬੰਧ ਹੈ ਇਸ ਨਾਲ ਸਿੰਘ ਆਪਣੇ ਜੰਗੀ ਜੌਹਰਾਂ ਦਾ ਪ੍ਰਦਰਸ਼ਨ ਕਰਦੇ ਹਨ